ਮੈਂ ਆਪਣੇ ਹਵਾਲਾ ਜੀਵਨ ਵਿੱਚ ਕਈ ਫੋਟੋਆਂ ਨੂੰ ਦੇਖ ਕੇ ਡਰਾਇੰਗ ਕਰਦਾ ਹਾਂ ਜਿਵੇਂ ਕਿ ਸਮੁੰਦਰ ਕਿਨਾਰੇ ਬੈਠਾ ਬੱਚਾ ਆਸਮਾਨ ਵਿੱਚ ਉੱਡ ਰਹੇ ਪੰਛੀ ਜਿਵੇਂ ਬਾਏ ਫੇਸ ਕਿਸੇ ਦੀ ਡਰਾਇੰਗ ਬਣਾਉਣਾ ਜਿਵੇਂ ਕਿ ਸਮੁੰਦਰੀ ਤੱਟ 'ਤੇ ਨਾਰੀਅਲ ਪੇੜ ਦੀ ਡਰਾਇੰਗ ਇਸ ਪੇਂਟਿੰਗਾਂ ਦੌਰਾਨ ਮੈਂ ਡਰਾਇੰਗ ਜੀਵਨ ਤੱਕ ਪਹੁੰਚਿਆ ਹੁਣ ਇਸ ਦੇ ਫਾਇਦੇ ਇਹ ਹਨ ਕਿ ਮੈਂ ਇਨਸਾਨ ਦੀ ਇੱਕ ਜਾਂ ਕਿਸੇ ਖਾਸ ਜਗ੍ਹਾ ਦੀ ਅੱਛੀ ਡਰਾਇੰਗ ਬਣਾ ਕੇ ਮਾਰਕੀਟ ਵਿੱਚ ਵੱਧ ਤੋਂ ਵੱਧ ਰੇਟ ਵਿੱਚ ਵਧੀਆ ਕੀਮਤ ਵਿੱਚ ਇਸ ਨੂੰ ਮੈਂ ਵੇਚ ਸਕਦਾ ਹਾਂ ਅਤੇ ਇਸ ਦੀਆਂ ਚੁਣੌਤੀਆਂ ਇਹ ਹਨ ਕਿ ਕਈ ਥਰਡ ਪਰਸਨ ਮੈਨੂੰ ਕਹਿ ਦਿੰਦੇ ਹਨ ਕਿ ਤੁਹਾਡੇ ਤੋਂ ਵਧੀਆ ਪੇਂਟਿੰਗ ਕੋਈ ਹੋਰ ਵੀ ਕਰ ਸਕਦਾ ਹੈ